ਮੋਹਾਲੀ ਜ਼ਿਲ੍ਹੇ ਵਿੱਚ ਬਹੁਤ ਖੇਡਾਂ ਅਤੇ ਮਨੋਰੰਜਨ ਦੇ ਸਾਧਨ ਹਨ ਇਕ ਤਾਂ ਮੇਨ ਇੱਥੇ ਮੋਹਾਲੀ ਵਿੱਚ ਕ੍ਰਿਕਟ ਦਾ ਸਟੇਡੀਅਮ ਹੈ ਅਤੇ ਬਾਕੀ ਇੱਥੇ ਹਰੇਕ ਤਰ੍ਹਾਂ ਦੀ ਖੇਡ ਖੇਡੀ ਜਾਂਦੀ ਹੈ ਅਤੇ ਇੱਥੇ ਮਨੋਰੰਜਨ ਲਈ ਬਹੁਤ ਪਾਰਕ ਸਿਨੇਮਾ ਘਰ ਹਨ ਅਤੇ ਲੋਕ ਇੱਥੇ ਦੇ ਬਾਜ਼ਾਰਾਂ ਵਿੱਚ ਬਹੁਤ ਵਧੀਆ ਹੋਣ ਕਾਰਨ ਇੱਥੇ ਜਾਂਦੇ ਹਨ ਅਤੇ ਲੋਕਾਂ ਵਿੱਚ ਆਪਸੀ ਭਾਈਚਾਰਾ ਵੀ ਬਹੁਤ ਹੈ ਅਤੇ ਹਰੇਕ ਤਿਉਹਾਰ ਜਿਵੇਂ ਕਿ ਦੀਵਾਲੀ ਦੁਸਹਿਰਾ ਹਰੇਕ ਇਕੱਠੇ ਹੋ ਕੇ ਹਰੇਕ ਆਪਣੇ ਧਰਮ ਨਾਲ ਜਿਵੇਂ ਚਾਹੇ ਕੋਈ ਹਿੰਦੂ ਹੋਵੇ ਚਾਹੇ ਸਰਦਾਰ ਚਾਹੇ ਮੁਸਲਿਮ ਹਰੇਕ ਆਪਣਾ ਭਾਈਚਾਰੇ ਨਾਲ ਇੱਥੇ ਤਿਉਹਾਰ ਮਨਾਉਂਦਾ ਹੈ